ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਗੁਆਂਢਣ ਬੋਲ ਰਹੀ ਹਾਂ ਮੈਂ ਤੁਹਾਨੂੰ ਦੱਸਣਾ ਸੀ ਕਿ ਮੈਂ ਅਜੇ ਥੋੜ੍ਹੀ ਕੁਝ ਦਿਨਾਂ ਪਹਿਲਾਂ ਹੀ ਇੱਧਰ ਸ਼ਿਫਟ ਹੋਈ ਹਾਂ ਤਾਂ ਮੈਨੂੰ ਇੱਥੇ ਮੌਸਮ ਦਾ ਕੁਝ ਪਤਾ ਨਹੀਂ ਚੱਲ ਰਿਹਾ ਕਦੇ ਗਰਮੀ ਹੋ ਜਾਂਦੀ ਹੈ ਕਦੇ ਬਾਰਿਸ਼ ਹੋਣ ਲੱਗ ਜਾਂਦੀ ਹੈ ਵੈਸੇ ਮੈਂ ਆਪਣੇ ਘਰੋਂ ਨਾ ਕੱਪੜੇ ਮੰਗਵਾਉਣੇ ਸੀ ਤਾਂ ਮੈਨੂੰ ਮੌਸਮ ਦਾ ਕੁਛ ਪਤਾ ਹੀ ਨਹੀਂ ਚੱਲ ਰਿਹਾ ਕੀ ਤੁਸੀਂ ਮੈਨੂੰ ਥੋੜ੍ਹਾ ਦੱਸ ਦੋਗੇ ਤਾਂ ਮੈਂ ਕੱਪੜੇ ਮੰਗਵਾ ਲਾ ਕਿਵੇਂ ਕਰ ਸਕਦੇ ਹਾਂ

ਹਾਂਜੀ ਮੌਸਮ ਦੇ ਚੇਂਜ ਹੋਣ ਨਾਲ ਤਾਂ ਬੱਚੇ ਬਿਮਾਰ ਵੀ ਹੋ ਜਾਂਦੇ ਹੈ ਉਹਨਾਂ ਦੀ ਵੀ ਕੋਈ ਲਾਗੇ ਤੁਹਾਡੇ ਕੋਈ ਹੈਗਾ ਕੋਈ ਡਾਕਟਰ ਲਾਗੇ ਡਿਸਪੈਂਸਰੀ ਸਾਨੂੰ ਕੋਈ ਲੋੜ ਪਏ ਤਾਂ ਅਸੀਂ ਜਲਦੀ ਤੋਂ ਜਲਦੀ ਪਹੁੰਚ ਸਕੀਏ ਹਾਂਜੀ ਧੰਨਵਾਦ ਜੀ ਤੁਸੀਂ ਮੇਰੀ ਹੈਲਪ ਕੀਤੀ ਹਾਂਜੀ ਚੰਗਾ ਜੀ